ਅਸੀਂ ਆਪਣੇ ਜੀਵਨ ਵਿੱਚ ਸ਼ੁੱਭ ਘਟਨਾ ਦੀ ਸ਼ੁਰੂਆਤ ਇਵੇਂ ਕਰਦੇ ਹਾਂ ਜਿਵੇਂ ਕਿ ਅਸੀਂ ਆਪਣੇ ਘਰ ਵਿੱਚ ਸੰਗਤ ਕਰਵਾਉਂਦੇ ਹਾਂ ਅਸੀਂ ਆਪਣੇ ਘਰ ਵਿੱਚ ਪਾਸਟਰਾਂ ਨੂੰ ਸੱਦਦੇ ਹਾਂ ਅਤੇ ਉਹ ਸਾਡੇ ਘਰ ਆਣ ਕੇ ਸੰਗਤ ਨੂੰ ਲੈ ਕੇ ਆਉਂਦੇ ਨੇ ਅਤੇ ਉਹ ਵਚਨ ਪੜ੍ਹਦੇ ਨੇ ਬਾਇਬਲ ਸੁਣਾਉਂਦੇ ਨੇ ਅਤੇ ਨਾਲੇ ਸਾਡੇ 'ਤੇ ਦੁਆ ਕਰਦੇ ਨੇ ਸਾਡੇ ਵਾਸਤੇ ਭਲਾ ਮੰਗਦੇ ਨੇ ਅਤੇ ਅਸੀਂ ਸਾਰਾ ਪਰਿਵਾਰ ਬਹਿ ਕੇ ਉਸ ਸੰਗਤ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਅਸੀਂ ਖੁਸ਼ੀ ਖੁਸ਼ੀ ਆਪਣੇ ਘਰ ਸੰਗਤ ਕਰਵਾਉਂਦੇ ਹਾਂ ਔਰ ਜਿਸ ਘਟਨਾ ਵਾਸਤੇ ਅਸੀਂ ਸੰਗਤ ਕਰਵਾਈ ਹੁੰਦੀ ਹੈ ਪਾਸਟਰ ਉਹਦੇ ਬਾਰੇ ਪ੍ਰਭੂ ਦੇ ਅੱਗੇ ਦੁਆ ਪ੍ਰਾਰਥਨਾ ਕਰਦੇ ਨੇ ਕਿ ਜੋ ਇਹਨਾਂ ਨੇ ਆਪਣੇ ਘਰ ਦੇ ਵਿੱਚ ਸੰਗਤ ਰੱਖੀ ਹੈ ਜਿਸ ਕੰਮ ਵਾਸਤੇ ਰੱਖੀ ਹੈ ਪਰਮੇਸ਼ਰ ਉਸ ਕੰਮ ਨੂੰ ਪੂਰਾ ਕਰੇ ਔਰ ਅਗਰ ਕੀਤਾ ਵੀ ਹੈ ਤਾਂ ਸਹੀ ਸਲਾਮਤ ਸਾਰਿਆਂ ਨੂੰ ਖ ਰਾਜ਼ੀ ਖੁਸ਼ੀ ਘਰ ਰੱਖੇ ਔਰ ਇਸ ਦੇ ਵਾਸਤੇ ਅਸੀਂ ਆਪਣੇ ਘਰ 'ਚ ਸੰਗਤ ਕਰਵਾਉਂਦੇ ਹਾਂ ਔਰ ਜੋ ਵੀ ਸਾਡੇ ਘਰ ਸ਼ੁੱਭ ਘਟਨਾ ਹੁੰਦੀ ਹੈ ਅਸੀਂ ਸਭ ਤੋਂ ਪਹਿਲਾਂ ਆਪਣੇ ਪਾਸਟਰਾਂ ਨੂੰ ਸੂਚਿਤ ਕਰਦੇ ਹਾਂ ਕਿ ਸਾਡੇ ਘਰ ਆਣ ਕੇ ਦੁਆ ਪ੍ਰਾਰਥਨਾ ਕਰੋ ਵਚਨ ਸੁਣਾਉ ਔਰ ਬਾਇਬਲ ਪੜ੍ਹੋ